ਮੇਰੇ ਅਨੁਸਾਰ ਭੰਗੜਾ ਐਰੋਬਿਕਸ ਬਾਰੇ ਲੋਕ ਇਹ ਸੋਚਦੇ ਹਨ ਕੀ ਭੰਗੜਾ ਐਰੋਬਿਕਸ ਕਰਨ ਨਾਲ ਸਿਰਫ ਨੱਚਣ ਦਾ ਅਨੁਭਵ ਹੋਣਾ ਜਰੂਰੀ ਹੈ ਲੇਕਿਨ ਮੇਰੇ ਅਨੁਸਾਰ ਇਹ ਗਲਤ ਫਹਿਮੀਆਂ ਹਨ ਕਿਉਂਕਿ ਭੰਗੜਾ ਐਰੋਬਿਕਸ ਵਿੱਚ ਨੱਚਣ ਦੀ ਬਜਾਏ ਸਿਰਫ ਹਲਕੇ ਕਦਮ ਦਾ ਵੀ ਇਸਤੇਮਾਲ ਹੁੰਦਾ ਹੈ ਜੋ ਹਰ ਕਿਸੇ ਲਈ ਫਿਟ ਰਹਿਣ ਵਾਸਤੇ ਮਦਦ ਕਰਦਾ ਹੈ ਕਈ ਵਾਰ ਲੋਕ ਇਹ ਵੀ ਮੰਨਦੇ ਹਨ ਕਿ ਭੰਗੜਾ ਐਰੋਬਿਕਸ ਬਹੁਤ ਜਿਆਦਾ ਹਲਚਲ ਵਾਲਾ ਕੰਮ ਹੈ ਪਰ ਇਹ ਇੱਕ ਸਧਾਰਨ ਅਤੇ ਖੁਸ਼ੀ ਭਰਿਆ ਵਰਕ ਆਊਟ ਹੈ ਜੋ ਕਿਸੇ ਵੀ ਫਿਟਨੈਸ ਵਾਲੇ ਲੋਕ ਕਰ ਸਕਦੇ ਹਨ ਕਈ ਲੋਕ ਇਹ ਸੋਚਦੇ ਹਨ ਕੀ ਭੰਗੜਾ ਅਤੇ ਐਰੋਬਿਕਸ ਸਿਰਫ ਭੰਗੜਾ ਪ੍ਰੇਮੀ ਹੀ ਕਰ ਸਕਦੇ ਹਨ ਜਾਂ ਸਿਰਫ ਜਿਹਨੂੰ ਭੰਗੜਾ ਹੀ ਆਉਂਦਾ ਹੋਵੇ ਪਰ ਭੰਗੜਾ ਬੰਦਾ ਆਪਣੀ ਸਿਹਤ ਨੂੰ ਸਹੀ ਅਤੇ ਤੰਦਰੁਸਤ ਰੱਖਣ ਲਈ ਵੀ ਕਰ ਸਕਦਾ ਹੈ ਲੋਕਾਂ ਨੂੰ ਇਹ ਸਮਝਾਉਣਾ ਜਰੂਰੀ ਹੈ ਕਿ ਭੰਗੜਾ ਐਰੋਬਿਕਸ ਨਾਲ ਸਿਰਫ ਨੱਚਣ ਦਾ ਤਜਰਬਾ ਹੋਣਾ ਜਰੂਰੀ ਨਹੀਂ ਹੈ ਇਹ ਇੱਕ ਮਜੇਦਾਰ ਅਤੇ ਪ੍ਰਭਾਵਸ਼ਾਲੀ ਫਿਟਨੈਸ ਰੂਟੀਨ ਹੈ ਜੋ ਸਰੀਰ ਨੂੰ ਤੰਦਰੁਸਤ ਰੱਖਦਾ ਹੈ ਭੰਗੜਾ ਐਰੋਬਿਕਸ ਨੂੰ ਹੌਲੀ ਹੌਲੀ ਸ਼ੁਰੂ ਕਰਨ ਦੀ ਸਮਾਜ ਨੂੰ ਬਹੁਤ ਜਰੂਰਤ ਹੈ ਜਿਸ ਦੇ ਨਾਲ ਉਨਾਂ ਦੀ ਸ਼ਰੀਰਿਕ ਤੰਦਰੁਸਤੀ ਵੜਦੀ ਰਹੂਗੀ